ਨੌ ਲੱਖ ਨੜਿੱਨਵੇਂ ਹਜ਼ਾਰ ਨੌ ਸੌ ਅਠਾਨਵੇਂ ਅੱਠ ਲੱਖ ਸੱਤਰ ਹਜ਼ਾਰ ਛੇ ਸੌ ਬਾਰ੍ਹਾਂ ਸੱਤ ਲੱਖ ਛਿਆਹਠ ਹਜ਼ਾਰ ਸੱਤ ਸੌ ਵੀਹ ਛੇ ਲੱਖ ਤੇਤੀ ਹਜ਼ਾਰ ਚਾਰ ਸੌ ਤੇਰ੍ਹਾਂ ਪੰਜ ਲੱਖ ਪਚਾਨਵੇਂ ਹਜ਼ਾਰ ਇੱਕ ਸੌ ਨੱਬੇ